ਹੈਲੋ ਹਾਂਜੀ ਹਾਂਜੀ ਵਧੀਆ ਵਧੀਆ ਜੀ ਤੁਸੀਂ ਸੁਣਾਓ ਕੀ ਹਾਲ ਚਾਲ ਤੁਹਾਡੇ ਹੋਰ ਕੀ ਅੱਛਾ ਜੀ ਅੱਛਾ ਮੈਂ ਤਾਂ ਆਪਦੇ ਬੱਚਿਆਂ ਨੂੰ ਇੱਕ ਨੂੰ ਤਾਂ ਆਰਮੀ ਸਕੂਲ ਵਿੱਚ ਪਾਇਆ ਇੱਕ ਨੂੰ ਮੈਂ ਸਰਬਿਤਕਾਰੀ ਪਾਇਆ ਅਤੇ ਦੋਵੇਂ ਪੜ੍ਹਾਈਆਂ ਵਧੀਆ ਕਰੀ ਜਾਂਦੇ ਨੇ ਜੀ ਤੁਹਾਡੇ ਕਿਹੜੀ ਰਾਇ ਆਰਮੀ ਸਕੂਲ ਇੱਕ ਹੋ ਗਏ ਦੋਵੇਂ ਸੀ ਬੀ ਐਸ ਈ ਨੇ ਬਸ ਆ ਜੀ ਆਰਮੀ ਸਕੂਲ ਥੋੜ੍ਹਾ ਜਿਵੇ ਆਰਮੀ ਵਾਲਾ ਏਰੀਆ ਤਾਂ ਥੋੜ੍ਹਾ ਆਪਾਂ ਉਸ 'ਤੇ ਨਵੀਂ ਸੀਟ ਬੰਦ ਦਿੰਦੀ ਏ ਸਰਬਿਤਕਾਰੀ ਵੀ ਸਕੂਲ ਵਧੀਆ ਉੱਥੇ ਸਪੋਰਟ ਦਾ ਵਧੀਆ ਰਹਿੰਦਾ ਸਾਰਾ ਬੱਚੇ ਕਾਫ਼ੀ ਅੱਗੇ ਤੱਕ ਜਾਂਦੇ ਨੇ ਪੜ੍ਹਾਈ ਦਾ ਵੀ ਚੰਗਾ ਆਹ ਹਾਂ ਉਹ ਥੋੜ੍ਹਾ ਉਹ ਕਰ ਦਿੰਦੇ ਨੇ ਹਾਂਜੀ ਹਾਂਜੀ ਉਹਨਾਂ ਨੂੰ ਜਿਵੇਂ ਆਰਮੀ ਵਾਲੇ ਨੇ ਨਾ ਉਹਨਾਂ ਨੂੰ ਦੇਖ ਕੇ ਡਿਸਿਪਲਿਨ ਬਣਿਆ ਰਵੇ ਤੋ ਉਹ ਚੱਕਰ ਹੈ ਜੋ ਬੱਚੇ ਦਾ ਥੋੜ੍ਹਾ ਹੈ ਆਰਮੀ ਦੇ ਤਰੀਕੇ ਨਾਲ ਹੀ ਉਹਨਾਂ ਨੂੰ ਕਰ ਦਿੰਦੇ ਨੇ ਅਤੇ ਜੇਕਰ ਐਵੇਂ ਤਾਂ ਸਰਬਿਤਕਾਰੀ ਵੀ ਚੰਗਾ ਹੈ ਮੇਰੇ ਮੇਰਾ ਇੱਕ ਬੱਚਾ ਸਰਬਤਕਾਰੀ 'ਚ ਹੀ ਪੜ੍ਹਦਾ ਹੈ ਵਧੀਆ ਹੈ ਦੋਵੇਂ ਹੀ ਡਿਸਿਪਲਿਨਡ ਨੇ ਐਹੋ ਜਿਹੀ ਕੋਈ ਗੱਲ ਨਹੀਂ ਹਾਂਜੀ ਹਾਂਜੀ ਨਹੀਂ ਸਰਬਿਤਕਾਰੀ ਵੀ ਚੰਗਾ ਹੈ ਹਾਂਜੀ ਹਾਂਜੀ ਸਪੋਰਟਸ ਦਾ ਵੀ ਉਹ ਪੂਰਾ ਧਿਆਨ ਰੱਖਦੇ ਨੇ ਮਤਲਬ ਕਾਫੀ ਉਹਨਾਂ ਦੀ ਟੀਮਾਂ ਬੱਚਿਆਂ ਅੱਗੇ ਹਾਂ ਮੈਨੂੰ ਆਹ ਆ ਮੇਰੀ ਬੇਟੀ ਆਪ ਹੀ ਦੱਸਦੀ ਹੈ ਕਿ ਉਹਦੀ ਫਰੈਂਡ ਹਾਂਜੀ ਹਾਂਜੀ ਇਹਨਾਂ ਦੇ ਦੋਸਤਾਂ ਬੇਟੀ ਵਿੱਚ ਕਦੇ ਕਿੱਥੇ ਖੇਡਣ ਜਾ ਰਹੇ ਨੇ ਕਦੇ ਕਿੱਥੇ ਖੇਡਣ ਜਾ ਰਹੇ ਨੇ ਪੂਰਾ ਧਿਆਨ ਰੱਖਦੇ ਨੇ ਉਹ ਵੀ ਹਾਂ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ